ਮੈਂ ਜ ਮੈਂ ਸਭ ਤੋਂ ਪਹਿਲਾ ਪ੍ਰੋਡਕਟ ਇੱਕ ਫੋਨ ਲਿੱਤਾ ਸੀ ਜੋ ਕਿ ਮੈਂ ਦਸਵੀਂ ਕਲਾਸ ਦੇ ਵਿੱਚ ਆਪਣੇ ਵਧੀਆ ਨੰਬਰ ਲਿਆਉਣ ਕਰਕੇ ਲਿੱਤਾ ਸੀ ਜੋ ਕਿ ਇੱਕ ਐਪਲ ਦਾ ਆਈਫੋਨ ਐਕਸ ਸੀ ਉਹ ਚੌਂਹਠ ਜੀ ਬੀ ਅਤੇ ਨਾਲ ਕਾਲੇ ਰੰਗ ਦਾ ਸੀ ਉਹ ਉਸ ਟਾਈਮ ਨਵਾਂ ਨਵਾਂ ਹੀ ਲੌਂਚ ਹੋਇਆ ਸੀ ਉਸਦੀ ਕਿਲ ਕੁੱਲ ਕੀਮਤ ਇੱਕ ਲੱਖ ਰੁਪਇਆ ਸੀ ਜਿਹੜਾ ਮੈਨੂੰ ਮੇਰੀ ਭੈਣ ਨੇ ਤੋਹਫਾ ਦਿੱਤਾ ਸੀ ਉਹ ਮੇਰਾ ਮਨਪਸੰਦ ਫੋਨ ਸੀ ਕਿਉਂਕਿ ਉਹ ਮੈਨੂੰ ਮੇਰੀ ਭੈਣ ਨੇ ਤੋਹਫੇ ਦੇ ਵਿੱਚ ਦਿੱਤਾ ਸੀ ਜੋ ਕਿ ਮੈਂ ਅਜੇ ਤੱਕ ਸਾਂਭ ਕੇ ਰੱਖਿਆ ਹੋਇਆ ਹੈ ਉਸਦੇ ਵਿੱਚ ਮੇਰੀ ਬਹੁਤ ਸਾਰੀ ਯਾਦਾਂ ਜੁੜੀਆਂ ਹੋਈਆਂ ਹਨ ਜਿਵੇਂ ਕਿ ਉਹ ਮੇਰਾ ਸਭ ਤੋਂ ਪਹਿਲਾ ਆਈਫੋਨ ਸੀ ਜਿਹੜਾ ਮੈਂ ਵਰਤਿਆ ਅਤੇ ਨਾਲ ਦੀ ਨਾਲ ਮੈਨੂੰ ਆਈਫੋਨ ਵਰਤਣ ਦਾ ਬਹੁਤ ਜ਼ਿਆਦਾ ਸ਼ੌਕ ਸੀ ਅਤੇ ਮੈਂ ਉਹ ਫੋਨ ਲੈ ਕੇ ਬਹੁਤ ਖੁਸ਼ ਹੋਇਆ ਕਿਉਂਕਿ ਉਹ ਮੇਰੇ ਮਨਪਸੰਦ ਰੰਗ ਕਾਲੇ ਰੰਗ ਦਾ ਸੀ ਕਿਉਂਕਿ ਉਹ ਬਹੁਤ ਸੋਹਣਾ ਲੱਗਦਾ ਹੈ ਕਾਲੇ ਰੰਗ ਦੇ ਵਿੱਚ ਇਸ ਕਰਕੇ ਮੈਂ ਆਪਣੀ ਭੈਣ ਨੂੰ ਬਹੁਤ ਜ਼ਿਆਦਾ ਯਾਦ ਧੰਨਵਾਦ ਕਰਦਾ ਹਾਂ ਜਦੋਂ ਉਹਨੇ ਮੈਨੂੰ ਮੇਰੀ ਮਨਪਸੰਦ ਚੀਜ਼ ਮੈਨੂੰ ਤੋਹਫੇ ਦੇ ਵਿੱਚ ਦੇ ਦਿੱਤੀ ਜਿਸ ਦੇ ਕਾਰਨ ਕੀ ਹੈ ਉਹ ਮੈਂ ਉਸਦੇ ਨਾਲ ਮੈਂ ਆਪਣੀ ਯਾਦਾਂ ਬਣਾ ਸਕਿਆ ਅਤੇ ਉਹਨੂੰ ਸਦੈਵ ਲਈ ਆਪਣੇ ਲਵੇ ਰੱਖਾਂਗਾ ਕਿਉਂਕਿ ਉਹ ਸਭ ਤੋਂ ਪਹਿਲਾ ਪ੍ਰੋਡਕਟ ਸੀ ਜਿਹੜਾ ਮੇਰੀ ਭੈਣ ਨੇ ਮੇਰਾ ਮਨਪਸੰਦ ਬਰੈਂਡ ਦਾ ਲੈ ਕੇ ਦਿੱਤਾ ਸੀ ਕਿਉੰਕਿ ਉਹ ਸਭ ਤੋਂ ਮਹਿੰਗਾ ਫੋਨ ਹੈ ਇਸ ਕਰਕੇ ਮੈਂ ਅਜੇ ਤੱਕ ਉਹਨੂੰ ਆਪਣੇ ਲਵੇ ਰੱਖਿਆ ਹੋਇਆ ਹੈ ਜਿਵੇਂ ਜਿਵੇਂ ਟਾਈਮ ਵੱਧਦਾ ਜਾਵੇਗਾ ਉਵੇਂ ਉਵੇਂ ਮੈਂ ਉਹਨੂੰ ਹੋਰ ਸੰਭਾਲ ਕੇ ਰੱਖਾਂਗਾ ਅਤੇ ਮੈਂ ਆਪਣੀ ਭੈਣ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਹੜਾ ਉਹਨੇ ਮੈਨੂੰ ਇੰਨਾ ਸੋਹਣਾ ਜਿਹਾ ਫੋਨ ਅਤੇ ਮੇਰਾ ਮਨਪਸੰਦ ਦੇ ਤੌਰ 'ਤੇ ਲੈ ਕੇ ਦਿੱਤਾ ਅਤੇ ਉਸਦਾ ਮੈਂ ਆਜੀਵਨ ਧੰਨਵਾਦ ਕਰਦਾ ਰਹਾਂਗਾ ਅਤੇ ਉਸਦੇ ਨਾ ਉਸਦੇ ਕਾਰਨ ਹੀ ਮੈਂ ਬਹੁਤ ਜ਼ਿਆਦਾ ਖੁਸ਼ ਰਹਿ ਪਾਇਆ ਅਤੇ ਉਹਨੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਹੋਰ ਲਿਆ ਕੇ ਦਿੱਤੀਆਂ ਬਟ ਜੋ ਮੇਰੀ ਮਨਪਸੰਦ ਚੀਜ਼ ਸੀ ਉਹਨੇ ਮੈਨੂੰ ਆਪਣੇ ਹੱਥਾਂ ਨਾਲ ਮੈਨੂੰ ਸੌਂਪ ਦਿੱਤੀ ਅਤੇ ਉਸ ਚੀਜ਼ ਦਾ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਅਤੇ ਜਿਵੇਂ ਜਿਵੇਂ ਜ਼ਿੰਦਗੀ ਅੱਗੇ ਵੱਧਦੀ ਜਾਵੇਗੀ ਉਹ ਇੱਦਾਂ ਇੱਦਾਂ ਦੀ ਹੀ ਚੀਜ਼ਾਂ ਮੈਨੂੰ ਤੋਹਫੇ ਦੇ ਵਿੱਚ ਦਿੰਦੀ ਰਹੇ ਅਤੇ ਉਸਦਾ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ